ਰੂਪਨਗਰ ਜ਼ਿਲ੍ਹੇ ਵਿੱਚ ਸ਼ਹੀਦੀ ਦਿਹਾੜੇ ਦਸੰਬਰ ਮਹੀਨੇ ਵਿੱਚ ਮਨਾਏ ਜਾਂਦੇ ਜਿਹੜੇ ਕਿ ਰੋਪੜ ਜ਼ਿਲ੍ਹੇ ਵਿੱਚ ਮਸ਼ਹੂਰ ਹਨ ਇਸ ਸ਼ਹੀਦੀ ਦੇ ਦਿਹਾੜੇ ਇਸ ਲਈ ਮਨਾਏ ਜਾਂਦੇ ਹਨ ਕਿਉਂਕਿ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸ਼ ਸਾਹਿਬ ਨੂੰ ਛੱਡਿਆ ਸੀਗਾ ਅਤੇ ਸਰਸਾ ਨਦੀ ਵਿੱਚ ਉਹਨਾਂ ਦਾ ਪਰਿਵਾਰ ਵਿਛੜ ਗਿਆ ਪਰਿਵਾਰ ਵਿਛੜਨੇ ਤੋਂ ਬਾਅਦ ਕੁਝ ਉਹਨਾਂ ਦੇ ਜਿਹੜੇ ਪੁੱਤਰ ਸੀਗੇ ਉਹ ਉਹਨਾਂ ਨੂੰ ਚਮਕੌਰ ਸ਼ਹੀਦੀ ਪ੍ਰਾਪਤ ਕੀਤੀ ਅਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੇ ਸ਼ੀ ਅ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਪ੍ਰਾਪਤ ਕੀਤੀ ਜਿਹਨਾਂ ਨਾਲ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦੀ ਪ੍ਰਾਪਤ ਕਰ ਗਿਆ